ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਆਪਣਾ ਇੱਕ ਵਿਚਾਰ ਸਾਂਝਾ ਕਰਨਾ ਚਾਹੁੰਦੀ ਹਾਂ ਮੈਂ ਜਿਵੇਂ ਆਨਲਾਈਨ ਸ਼ਾਪਿੰਗ ਬਹੁਤ ਕਰਦੀ ਹਾਂ ਅਤੇ ਕੁਝ ਸਮੇਂ ਪਹਿਲਾਂ ਦਿਵਾਲੀ ਦਾ ਟਾਈਮ ਸੀਗਾ ਅਤੇ ਮੈਂ ਸੋਚਿਆ ਸੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਇੱਕ ਦਿਵਾਲੀ ਦਾ ਤੋਹਫਾ ਦੂੰਗੀ ਅਤੇ ਮੈਂ ਉਹਦੇ ਵਿੱਚੋਂ ਇਹ ਡਿਨਰ ਸੈਟ ਪਸੰਦ ਕੀਤਾ ਸੀਗਾ ਇੱਕ ਬਹੁਤ ਵਧੀਆ ਮੈਨੂੰ ਡਿਨਰ ਸੈਟ ਲੱਗਿਆ ਅਤੇ ਮੈਂ ਉਹ ਆਰਡਰ ਕਰਤਾ ਸੀਗਾ ਕੰਪਨੀ ਵਾਲਿਆਂ ਨੇ ਮੈਨੂੰ ਕਿਹਾ ਕਿ ਇਹ ਪੰਦਰ੍ਹਾਂ ਦਿਨ ਪਹਿਲਾਂ ਤੁਹਾਡੀ ਡਿਲੀਵਰੀ ਹੋ ਜਾਏਗੀ ਪਰ ਮੇਰੇ ਨਾਲ ਹੋਇਆ ਇਹ ਕਿ ਡਿਲੀਵਰੀ ਲੇਟ ਹੋ ਗਈ ਵੀਹ ਦਿਨਾਂ ਬਾਅਦ ਆਈ ਅਤੇ ਮੈਂ ਫਿਰ ਇੱਦਾਂ ਕੀਤਾ ਕਿ ਜਦੋਂ ਮੈਨੂੰ ਪਤਾ ਲੱਗਿਆ ਕਿ ਡਿਲੀਵਰੀ ਹੁਣ ਲੇਟ ਆਉਣੀ ਹੈ ਅਤੇ ਮੈਂ ਸਿੱਧਾ ਪਤਾ ਆਪਣੇ ਰਿਸ਼ਤੇਦਾਰਾਂ ਦਾ ਹੀ ਦੇ ਤਾ ਕਿ ਜਿਹਨਾਂ ਨੂੰ ਮੈਂ ਤੋਹਫਾ ਦੇਣਾ ਮੈਂ ਉਹਨਾਂ ਦਾ ਹੀ ਉਹ ਦੇ ਤਾ ਐਡਰੈਸ ਦੇ ਤਾ ਅਤੇ ਇਸ ਚੀਜ਼ ਵਿੱਚ ਮੇਰਾ ਬੁਰਾ ਅਨੁਭਵ ਇਹ ਸੀਗਾ ਕਿ ਜਦੋਂ ਇਹ ਉਹ ਸੈਟ ਉਹਨਾਂ ਕੋਲ ਗਿਆ ਅਤੇ ਜਦੋਂ ਉਹਨਾਂ ਨੇ ਖੋਲ੍ਹਿਆ ਉਹਦੇ ਵਿੱਚ ਦੋ ਪਲੇਟਾਂ ਟੁੱਟੀਆਂ ਸੀਗੀਆਂ ਉਹਨਾਂ ਦਾ ਡਿਨਰ ਸੈਟ ਖਰਾਬ ਆਇਆ ਸੀ ਮਤਲਬ ਅਤੇ ਉਹਨਾਂ ਨੇ ਫਿ ਫਿਰ ਜਿਹਨਾਂ ਨੂੰ ਮੈਂ ਤੋਹਫਾ ਦਿੱਤਾ ਸੀ ਉਹਨਾਂ ਨੇ ਜਦੋਂ ਦੇਖਿਆ ਅਤੇ ਉਹਨਾਂ ਨੇ ਉਹ ਟੁੱਟੀਆਂ ਪਲੇਟਸ ਦੀਆਂ ਉਹ ਟੁੱਟੇ ਡਿਨਰ ਸੈੱਟ ਦੀਆਂ ਫੋਟੋ ਮੈਨੂੰ ਭੇਜੀਆਂ ਜਿਸ ਨਾਲ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਅਤੇ ਮੈਂ ਕੰਪਨੀ ਵਾਲਿਆਂ ਨੂੰ ਫਿਰ ਕਿਹਾ ਕਿ ਇਹ ਤੁਹਾਡਾ ਸਮਾਨ ਇੱਦਾਂ ਇੱਦਾਂ ਇੱਕ ਤਾਂ ਇਹਨਾਂ ਨੇ ਡਿਲੀਵਰੀ ਲੇਟ ਕੀਤੀ ਸੀਗੀ ਫਿਰ ਉਤੋਂ ਉਹਨਾਂ ਦਾ ਸਮਾਨ ਵੀ ਟੁੱਟਿਆ ਹੋਇਆ ਸੀਗਾ ਅਤੇ ਮੈਂ ਇਹਨਾਂ ਨੂੰ ਕਿਹਾ ਕਿ ਤੁਹਾਡਾ ਸਮਾਨ ਟੁੱਟਿਆ ਹੋਇਆ ਆਇਆ ਹੈ ਅਤੇ ਪਹਿਲੀ ਗੱਲ ਤਾਂ ਇਹ ਮੰਨੇ ਹੀ ਨਹੀਂ ਆਪਣੀ ਗਲਤੀ ਕਿ ਸਾਡੇ ਮਤਲਬ ਸਮਾਨ ਟੁੱਟਿਆ ਹੋਇਆ ਹੈਗਾ ਇਹ ਫਿਰ ਇਸ ਤੋਂ ਬਾਅਦ ਜਦੋਂ ਇਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਕਾਫੀ ਵਾਰ ਮੈਂ ਕਿਹਾ ਫਿਰ ਮੈਂ ਇਹਨਾਂ ਦੇ ਕੰਪਨੀ ਦੇ ਉਹ ਕਮੈਂਟ ਕਰਨੇ ਸ਼ੁਰੂ ਕਰਤੇ ਕਿ ਤੁਹਾਡਾ ਸਮਾਨ ਇਦਾਂ ਇਦਾਂ ਖਰਾਬ ਆਇਆ ਹੈ ਅਤੇ ਮੇਰੇ ਕਮੈਂਟ ਪੜ੍ਹ ਕੇ ਹੋਰਾਂ ਲੋਕਾਂ ਨੇ ਵੀ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਜਿਸ ਨਾਲ ਕੰਪਨੀ ਵਾਲਿਆਂ ਦੇ ਵੀ ਸ਼ਰਮ ਪਈ ਅਤੇ ਉਹਨਾਂ ਨੇ ਫਿਰ ਮੇਰੇ ਪੈਸੇ ਵਾਪਸ ਕਰਤੇ ਸੀਗੇ ਪਰ ਮੇਰੇ ਪੈਸੇ ਤਾਂ ਵਾਪਸ ਕਰਤੇ ਪਰ ਜੋ ਮੈਨੂੰ ਸ਼ਰਮਿੰਦਗੀ ਮਹਿਸੂਸ ਹੋਈ ਉਹਨਾਂ ਅੱਗੇ ਕਿ ਇੱਕ ਤਾਂ ਮੈਂ ਟਾਈਮ 'ਤੇ ਉਹਨਾਂ ਨੂੰ ਤੋਹਫਾ ਨਹੀਂ ਦੇ ਸਕੀ ਅਤੇ ਦੂਜਾ ਉਹ ਜੋ ਮੈਂ ਮੰਗਵਾਇਆ ਸੀਗਾ ਸਮਾਨ ਉਹ ਵੀ ਟੁੱਟਿਆ ਹੋਇਆ ਆਇਆ ਜਿਸ ਨਾਲ ਮੇਰੀ ਬਹੁਤ ਬੇਇਜ਼ਤੀ ਮਹਿਸੂਸ ਹੋਈ ਅਤੇ ਇਹ ਮੇਰਾ ਮਤਲਬ ਬੁਰਾ ਅਨੁਭਵ ਰਿਹਾ ਧੰਨਵਾਦ